ਜਿਹੜੇ ਸਮਕਾਲੀਨ ਪੰਜਾਬੀ ਸੰਗੀਤ ਹੁੰਦੇ ਸਨ ਉਹ ਸੁਣਨ ਦੇ ਵਿੱਚ ਹੀ ਬਹੁਤ ਜ਼ਿਆਦਾ ਵਧੀਆ ਲੱਗਦੇ ਸਨ ਪੁਰਾਣੇ ਲੋਕ ਜਾਂ ਕਿ ਹੁਣ ਦੇ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਸਨ ਕਿਉਂਕਿ ਉਹਨਾਂ ਦੇ ਵਿੱਚ ਲੋਕਾਂ ਦੇ ਮਿਲ ਜੁਲ ਕੇ ਰਹਿਣ ਏਕਤਾ ਦੀ ਭਾਵਨਾ ਅਤੇ ਸੱਭਿਆਚਾਰ ਦੇ ਨਾਲ ਸੰਬੰਧਿਤ ਗੀਤ ਗਾਏ ਜਾਂਦੇ ਸਨ ਜੋ ਕਿ ਸੁਣਨ ਦੇ ਵਿੱਚ ਵੀ ਬਹੁਤ ਹੀ ਚੰਗੇ ਅਤੇ ਆਨੰਦਮਈ ਲੱਗਦੇ ਸਨ ਉਹਨਾਂ ਵਿੱਚ ਦੱਸਿਆ ਜਾਂਦਾ ਸੀ ਕਿ ਸਾਨੂੰ ਕਿਵੇਂ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਇੱਕ ਦੂਸਰੇ ਨਾਲ ਕਿਵੇਂ ਪਿਆਰ ਭਾਵਨਾ ਰੱਖਣੀ ਚਾਹੀਦੀ ਹੈ ਇੱਕ ਦੂਸਰੇ ਦੀ ਕਿਵੇਂ ਮਦਦ ਕਰਨੀ ਚਾਹੀਦੀ ਹੈ ਜਦੋਂ ਵੀ ਕੋਈ ਜੇ ਕੋਈ ਮੁਸ਼ਕਿਲ ਦੇ ਵਿੱਚ ਹੈ ਇਸਦੇ ਵਿੱਚ ਉਹਨਾਂ ਸੰਗੀਤਾਂ ਦੇ ਵਿੱਚ ਇੰਨਾ ਰਸ ਹੁੰਦਾ ਸੀ ਕਿ ਸੁ ਸੁਣਨ ਵਾਲੇ ਨੂੰ ਇੱਦਾਂ ਲੱਗਦਾ ਸੀ ਕਿ ਜਿਵੇਂ ਉਹ ਇੱਕ ਸਵਰਗ ਦੇ ਵਿੱਚ ਹੀ ਜਿਓ ਰਿਹਾ ਹੋਵੇ ਪਰ ਅੱਜ ਕੱਲ੍ਹ ਦੇ ਸੰਗੀਤ ਦੇ ਵਿੱਚ ਸੁਧਾਰ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਸੰਗੀਤ ਆ ਉਹਨਾਂ ਵਿੱਚ ਬੰਦੂਕਾਂ ਤਲਵਾਰਾਂ ਹਥਿਆਰਾਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਮਾਰੋ ਇੱਕ ਦੂਜੇ ਨੂੰ ਮਾਰੋ ਲੜਾਈ ਬਾਰੇ ਦੱਸਿਆ ਜਾਂਦਾ ਹੈ ਇਹਨੂੰ ਉਹਨੂੰ ਵੇਖ ਕੇ ਨੌਜਵਾਨ ਤਾਂ ਲੜਾਈ ਝਗੜੇ ਦੇ ਵਿੱਚ ਪੈਂਦੇ ਹੀ ਨੇ ਅਤੇ ਛੋਟੇ ਛੋਟੇ ਬੱਚੇ ਵਿੱਚ ਜੋ ਕਿ ਸਕੂਲਾਂ ਦੇ ਵਿੱਚ ਪੜ੍ਹਦੇ ਹਨ ਉਹ ਵੀ ਉਹਨਾਂ ਦਾ ਵੀ ਧਿਆਨ ਲੜਾਈ ਦੇ ਵੱਲ ਚਲਾ ਜਾਂਦਾ ਹੈ ਉਹ ਵੀ ਇੱਕ ਵੀ ਗੈਂਗਸਟਰ ਦੀ ਤਰ੍ਹਾਂ ਇੱਕ ਦੂਸਰੇ ਦੇ ਨਾਲ ਲੜਾਈਆਂ ਕਰਦੇ ਹਨ ਜੇ ਕੋਈ ਕਲਾਸ ਦੇ ਵਿੱਚ ਉਹਨਾਂ ਨੂੰ ਕੁਝ ਕਿਹਾ ਜਾਂਦਾ ਹੈ ਜਾਂ ਕੋਈ ਅਧਿਆਪਕ ਉਹਨਾਂ ਨੂੰ ਕੁਛ ਕਹਿ ਦਿੰਦਾ ਹੈ ਤਾਂ ਉਹ ਇੱਕ ਦੂ ਦੂਜੇ ਨਾਲ ਆਰਗੂਮੈਂਟਸ ਕਰਨ ਲੱਗ ਜਾਂਦੇ ਹਨ ਲੜਾਈ ਕਰਨ ਲੱਗ ਜਾਂਦੇ ਹਨ ਜਾਂ ਕੋਈ ਤੇਜ਼ ਹਥਿਆਰ ਚੀਜ਼ ਦੇ ਨਾਲ ਇੱਕ ਦੂਜੇ 'ਤੇ ਵਾਰ ਕਰਦੇ ਹਾ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਇਸ ਦੇ ਲਈ ਅੱਜ ਕੱਲ੍ਹ ਦੇ ਜਿਹੜੇ ਸੰਗੀਤ ਆ ਉਹਨਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ ਇਹਨਾਂ ਵਿੱਚ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਏਕਤਾ ਦੀ ਭਾਵਨਾ ਜਿਵੇਂ ਪੁਰਾਣੇ ਗੀਤਾਂ ਦੇ ਵਿੱਚ ਦੱਸਿਆ ਜਾਂਦਾ ਸੀ ਮਿਲ ਜੁਲ ਕੇ ਰਹਿਣਾ ਪਿਆਰ ਦੀ ਭਾਵਨਾ ਜਗਾਉਣਾ ਆਦਿ ਦੇ ਜਿਹੜੇ ਵਿਚਾਰ ਆ ਉਹ ਪੇਸ਼ ਕਰਨੇ ਚਾਹੀਦੇ ਹਨ ਨਾਲ ਹੀ ਇਸ ਦੇ ਵਿੱਚ ਪੁਰਾਣੇ ਸੱਭਿਆਚਾਰ ਨੂੰ ਵਾਪਿਸ ਲੈ ਕੇ ਆਉਣਾ ਚਾਹੀਦਾ ਤਾਂ ਜੋ ਕਿ ਪੰਜਾਬ ਦੇ ਮਾਹੌਲ ਨੂੰ ਪਹਿਲਾਂ ਦੀ ਤਰ੍ਹਾਂ ਬਣਾਇਆ ਜਾ ਸਕੇ